ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਧਨਵੀਰ ਸਿੰਘ ਕੀ ਮੇਰੀ ਗੱਲ ਸ਼ਿਵ ਮੋਟਰਸ ਦੇ ਮੈਨੇਜਰ ਦਲਜੀਤ ਸਿੰਘ ਨਾਲ਼ ਹੋ ਰਹੀ ਹੈ ਮੈਂ ਤੁਹਾਨੂੰ ਇਹ ਦੱਸਣ ਲਈ ਫੋਨ ਕੀਤਾ ਹੈ ਕਿ ਮੈਨੂੰ ਰਾਜਸਥਾਨ ਜਾਣ ਲਈ ਗੱਡੀ ਦੀ ਲੋੜ ਹੈ ਅਤੇ ਇਸ ਟ੍ਰਿਪ ਲਈ ਮੈਨੂੰ ਵੱਡੀ ਗੱਡੀ ਦੀ ਲੋੜ ਹੈ ਜਿਵੇਂ ਕਿ ਇਨੋਵਾ ਜਾਂ ਸਕੋਰਪੀਓ ਇਸ ਵਿੱਚ ਮੇਰੇ ਫੈਮਲੀ ਮੈਂਬਰਸ ਨੇ ਜਾਣਾ ਹੈ ਅਤੇ ਇੱਕ ਤੁਹਾਡਾ ਡਰਾਈਵਰ ਹੈ ਜਿਹਦਾ ਨਾਮ ਮਨੀ ਸਿੰਘ ਹੈ ਉਹ ਸਾਡੇ ਨਾਲ ਅੱਗੇ ਵੀ ਦੋ ਤਿੰਨ ਵਾਰ ਟ੍ਰਿਪ 'ਤੇ ਗਿਆ ਹੈ ਅਤੇ ਉਹਦੇ ਨਾਲ ਸਾਡਾ ਫੈਮਲੀ ਵਾਲਾ ਕੰਮ ਹੈ ਮੈਂ ਚਾਹੁੰਦਾ ਹਾਂ ਕੀ ਤੁਸੀਂ ਉਸੇ ਨੂੰ ਭੇਜੋ ਅਤੇ ਉਹ ਸਾਡੇ ਨਾਲ ਫੈਮਿਲੀ ਫੈਮਿਲੀ ਵਾਂਗ ਰਹਿੰਦਾ ਹੈ ਇਸ ਇਹ ਟ੍ਰਿਪ ਅਸੀਂ ਮੰਡੇ ਸਵੇਰੇ ਸੱਤ ਵਜੇ ਜਾਣੀ ਹੈ ਅਤੇ ਇਹ ਟ੍ਰਿਪ ਚਾਰ ਦਿਨਾਂ ਦੀ ਹੋਵੇਗੀ ਜਿਹਦੇ ਵਿੱਚੋਂ ਅਸੀਂ ਦੋ ਦਿਨ ਉੱਥੇ ਲਗਾਵਾਂਗੇ ਅਤੇ ਇੱਕ ਦਿਨ ਆਉਣ ਜਾਣ ਲਈ ਲੱਗ ਜੇਗਾ ਅਸੀਂ ਥਰਸਡੇ ਨੂੰ ਅੱਠ ਏ ਐਮ ਵਜੇ ਵਾਪਸ ਆ ਜਾਣਾ ਅਤੇ ਇਸ ਟ੍ਰਿਪ ਦਾ ਜਿੰਨਾ ਵੀ ਬਜਟ ਹੋਇਆ ਉਹ ਤੁਸੀਂ ਮੈਨੂੰ ਦੱਸ ਦਿਓ ਕਿ ਨਾਲੇ ਪੇਮੈਂਟ ਦਾ ਮੈਥਡ ਗੂਗਲ ਪੇ ਜਾਂ ਪੇਟੀਐੱਮ ਰਾਹੀਂ ਹੋ ਸਕਦੀ ਹੈ ਧੰਨਵਾਦ